ਪਿਛਲੀਆਂ ਸਰਦੀਆਂ ਮੈਂ ਇੱਕ ਜੈਕਟ ਲਈ ਮੈਨੂੰ ਸੋਹਣੀ ਲੱਗੀ ਮੈਂ ਲਈ ਪਰ ਉਹ ਬਹੁਤ ਆਰਾਮਦਾਇਕ ਅਤੇ ਹਲਕੀ ਸੀ ਉਹ ਦੇ ਕਰਕੇ ਮੈਂ ਉਹ ਨੂੰ ਡੇਲੀ ਯੂਜ਼ 'ਚ ਯੂਜ਼ ਕੀਤਾ